ਅੱਜ ਰਾਤ ਅਸੀਂ ਫਿਲਮ ਵੇਖਣ ਦੀ ਯੋਜਨਾ ਬਣਾ ਰਹੇ ਹਾਂ ਪਰ ਵੇਖਣ ਨੂੰ ਜੋ ਆ ਰਿਹਾ ਹੈ ਫਿਲਮਾਂ ਜੋ ਚੱਲ ਰਹੀਆਂ ਹਨ ਉਹ ਬਹੁਤ ਜਿਆਦਾ ਵਧੀਆ ਨਹੀਂ ਹਨ ਇਹ ਫਿਲਮਾਂ ਸਿਰਫ ਕੌਡੀ ਨੂੰ ਲੈ ਕੇ ਹੀ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਇਹਨਾਂ ਫਿਲਮਾਂ ਦੀ ਕੋਈ ਵਧੀਆ ਸਟੋਰੀ ਨਹੀਂ ਹੁੰਦੀ ਇਹਨਾਂ ਫਿਲਮਾਂ ਵਿੱਚ ਕੋਈ ਵਧੀਆ ਮੈਸੇਜ ਨਹੀਂ ਹੁੰਦਾ ਇਹਨਾਂ ਫਿਲਮਾਂ ਨੂੰ ਲੈ ਕੇ ਲੋਕ ਕਾਫੀ ਉਤਸੁਕ ਹੁੰਦੇ ਹਨ ਪਰ ਇਹਨਾਂ ਫਿਲਮਾਂ ਵਿੱਚ ਕੋਈ ਜਿਆਦਾ ਖਾਸ ਵੇਖਣ ਨੂੰ ਨਹੀਂ ਹੁੰਦਾ ਇਹ ਫਿਲਮਾਂ ਨੂੰ ਵੇਖ ਕੇ ਲੋਕ ਹਮੇਸ਼ਾ ਇੱਕ ਤੋਂ ਦੂਜੇ ਦਿਨ ਭੁੱਲ ਜਾਂਦੇ ਹਨ ਇਹ ਫਿਲਮਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਨਹੀਂ ਬਣਾ ਪਾਉਂਦੀਆਂ ਇਹ ਫਿਲਮਾਂ ਅੱਜ ਕੱਲ ਸਿਰਫ ਕਮਾਈ ਦਾ ਸਾਧਨ ਬਣ ਕੇ ਰਹਿ ਗਈਆਂ ਹਨ ਕੋਈ ਵੀ ਨਿਰਦੇਸ਼ਕ ਆਪਣੀ ਇੱਛਾ ਜਾਂ ਆਪਣੀ ਪੂਰੀ ਵਾਹ ਲਾ ਕੇ ਇਹਨਾਂ ਫਿਲਮਾਂ ਨੂੰ ਨਹੀਂ ਬਣਾਉਣਦਾ ਫਿਲਮਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਲੋਕਾਂ ਦੇ ਦਿਲਾਂ ਵਿੱਚ ਬਹੁਤ ਵੱਡਾ ਪ੍ਰਭਾਵ ਪਾਉਣ ਅਤੇ ਲੋਕ ਉਸ ਨੂੰ ਬਹੁਤ ਲੰਮੇ ਸਮੇਂ ਤੱਕ ਯਾਦ ਰੱਖਣ ਫਿਲਮਾਂ ਬਹੁਤ ਵਧੀਆ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ ਇਹਨਾਂ ਨੂੰ ਵੇਖ ਕੇ ਲੋਕ ਆਪਣੇ ਆਪ ਨੂੰ ਢਾਲ ਲੈਂਦੇ ਹਨ ਅਤੇ ਇਹਨਾਂ ਦਾ ਲੋਕਾਂ ਦੇ ਕਾਫੀ ਅਸਰ ਹੁੰਦਾ ਹੈ ਇਹਨਾਂ ਤੋਂ ਲੋਕ ਸਿੱਖਦੇ ਹਨ ਅਤੇ ਆਪਣੀ ਜ਼ਿੰਦਗੀ ਬਦਲ ਲੈਂਦੇ ਹਨ ਪਰ ਇਹ ਫਿਲਮਾਂ ਜੇਕਰ ਗਲਤ ਮੈਸੇਜ ਦੇਣਗੀਆਂ ਨਾ ਹੀ ਕੋਈ ਮੈਸੇਜ ਚੰਗਾ ਹੋਵੇਗਾ ਤਾਂ ਲੋਕ ਕਿਵੇਂ ਆਪਣੇ ਆਪ ਨੂੰ ਸੁਧਾਰਨਗੇ ਫਿਲਮਾਂ ਕਾਫੀ ਵਧੀਆ ਵੀ ਹਨ ਪਰ ਅੱਜ ਕੱਲ ਇਹੋ ਜਿਹੀਆਂ ਵੇਖਣ ਨੂੰ ਨਹੀਂ ਮਿਲ ਰਹੀਆਂ ਜਿਵੇਂ ਕਿ ਬਹੁਤ ਪੁਰਾਣੀ ਫਿਲਮ ਹੈ ਥ੍ਰੀ ਈਡੀਅਟ ਜੋ ਕਿ ਆਮਿਰ ਖਾਨ ਦੀ ਫਿਲਮ ਹੈ ਉਸ ਵਿੱਚ ਬਹੁਤ ਵਧੀਆ ਸਟੋਰੀ ਹੈ ਉਸ ਵਿੱਚ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਕਿ ਲੋਕ ਆਪਣੇ ਆਪ ਨੂੰ ਲੋਕਾਂ ਦੇ ਨਾਲ ਢਾਲ ਲੈਂਦੇ ਹਨ ਆਪਣੀ ਕੋਈ ਇੱਛਾ ਨਹੀਂ ਰੱਖਦੇ ਉਹ ਲੋਕਾਂ ਨੂੰ ਵੇਖ ਕੇ ਆਪਣੇ ਕੰਮ ਕਾਜ ਕਰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਇਸ ਫਿਲਮ ਵਿੱਚ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਅਤੇ ਇੱਕ ਹੋਰ ਫਿਲਮ ਹੈ ਪੀ ਕੇ ਜੋ ਕਿ ਉਹ ਵੀ ਆਮਿਰ ਖਾਨ ਦੀ ਫਿਲਮ ਹੈ ਇਸ ਵਿੱਚ ਧਰਮ ਨੂੰ ਲੈ ਕੇ ਕਾਫੀ ਵਧੀਆ ਮੈਸੇਜ ਦਿੱਤਾ ਅਤੇ ਇਹ ਫਿਲਮ ਬਹੁਤ ਵਧੀਆ ਹੈ ਇਹ ਜੀਆ ਫਿਲਮਾਂ ਬਹੁਤ ਸਾਰੀਆਂ ਹਨ ਪਰ ਅੱਜ ਕੱਲ ਇਹ ਜੀਆਂ ਫਿਲਮਾਂ ਨਹੀਂ ਆ ਰਹੀਆਂ ਹਨ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਇਹਨਾਂ ਨਿਰਦੇਸ਼ਕਾਂ ਨੂੰ ਚਾਹੀਦਾ ਕਿ ਅਜਿਹੀਆਂ ਫਿਲਮਾਂ ਨੂੰ ਲੈ ਕੇ ਆਣ ਤਾਂ ਜੋ ਲੋਕਾਂ ਵਿੱਚ ਇਹੋ ਜਿਹੀ ਜਾਗਰੂਕਤਾ ਫੈਲੇ